ਮੈਂ ਅਤੁਲ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੇਰੇ ਨਾਨਾ ਜੀ ਜੋ ਕਿ ਖੁਦ ਖੇਤੀਬਾੜੀ ਕਰਦੇ ਹਨ ਮੈਂ ਉਨ੍ਹਾਂ ਤੋਂ ਬਹੁਤ ਕੁਛ ਸਿੱਖਿਆ ਹੈ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਪੇਂਡੂ ਭਾਈਚਾਰੇ ਵਿੱਚ ਖੇਤੀਬਾੜੀ ਦੇ ਵਿਕਾਸ ਲਈ ਬਹੁਤ ਸਾਰੀਆਂ ਸਰਕਾਰ ਦੁਆਰਾ ਜਾਂ ਫਿਰ ਖੁਦ ਲੋਕਾਂ ਦੁਆਰਾ ਹੀ ਮਸ਼ੀਨਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ ਕਿਉਂਕਿ ਮਸ਼ੀਨਾਂ ਦੇ ਉਪਯੋਗ ਨਾਲ ਜਾਂ ਫਿਰ ਨਵੀਂ ਜਿਹੜੀ ਖਾਦ ਆਉਂਦੀ ਹੈ ਜਾਂ ਉਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਦੀ ਕਿ ਉਪਯੋਗ ਨਾਲ ਖੇਤੀ ਨੂੰ ਬਹੁਤ ਵਧੀਆ ਕੀਤਾ ਜਾ ਸਕਦਾ ਹੈ ਜਿਹਦੀ ਵਜ੍ਹਾ ਨਾਲ ਕਿ ਅਨਾਜ ਤਾਂ ਵੱਧਦਾ ਹੀ ਹੈ ਉਸ ਤੋਂ ਇਲਾਵਾ ਖੇਤੀ ਦੇ ਵਿੱਚ ਫਸਲ 'ਚ ਵੀ ਸੁਧਾਰ ਹੁੰਦਾ ਹੈ ਅਤੇ ਮਿੱਟੀ ਵਿੱਚ ਵੀ ਸੁਧਾਰ ਹੁੰਦਾ ਹੈ ਜਿਹਦੇ ਨਾਲ ਕਿ ਖੇਤੀ ਤਾਂ ਵਧੀਆ ਹੁੰਦੀ ਹੈ ਕਿਸਾਨ ਵੀ ਕਾਫ਼ੀ ਵਧੀਆ ਰਹਿੰਦਾ ਹੈ ਉਸ ਤੋਂ ਇਲਾਵਾ ਮਸ਼ੀਨਾਂ ਦੇ ਉਪਯੋਗ ਨਾਲ ਖੇਤੀ ਸੌਖੀ ਵੀ ਹੋ ਜਾਂਦੀ ਹੈ ਤਾਂ ਕਿ ਕਿਸਾਨ ਨੂੰ ਸਾਰਾ ਟਾਇਮ ਮਿਹਨਤ ਨਹੀਂ ਕਰਨੀ ਪੈਂਦੀ ਅਤੇ ਉਹ ਅਰਾਮ ਨਾਲ ਘਰ ਬੈਠੇ ਬੈਠੇ ਵੀ ਸੋਚ ਸਕਦਾ ਹੈ ਕਿ ਉਸਦੀ ਫਸਲ ਵਧੀਆ ਹੋਵੇਗੀ